ਆਖਰੀ ਵਾਰ ਸਾਨੂੰ ਜਿਹੜਾ ਕੋਲਜ ਦੇ ਵਿੱਚ ਇੱਕ ਪ੍ਰਜੈਕਟ ਜਿਹੜਾ ਸਾਡੇ ਪ੍ਰੋਫੈਸਰ ਵੱਲੋਂ ਦਿੱਤਾ ਗਿਆ ਸੀਗਾ ਅਤੇ ਉਹ ਪ੍ਰੋਜੈਕਟ ਦੀ ਜਿਹੜੀ ਹੈੱਡ ਉਹ ਮੈਂ ਖੁਦ ਆਪ ਸੀ ਅਸੀਂ ਛੇ ਜਣਿਆ ਨੇ ਉਸ ਪ੍ਰੋਜੈਕਟ ਨੂੰ ਜਿਹੜਾ ਹੈ ਮਿਲਕੇ ਤਿਆਰ ਕਰਨਾ ਸੀ ਪਰ ਐਟ ਟਾਈਮ 'ਤੇ ਇੱਕ ਜਿਹੜਾ ਮੇਰਾ ਫ਼ਰੈਂਡ ਹੈ ਉਹ ਉਸ ਸਮੇਂ 'ਤੇ ਨਹੀਂ ਪੁੱਜ ਸਕਿਆ ਅਤੇ ਉਹਦੇ ਵੱਲੋਂ ਜਿਹੜੀ ਹੈ ਮੇਰੇ ਵੱਲੋਂ ਜਿਹੜੀ ਉਸ ਚੀਜ਼ ਦੇ ਵਿੱਚ ਇੱਕ ਕਮੀ ਰਹਿ ਗਈ ਪਰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਚੀਜ਼ ਨੂੰ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਕਲਾਸ ਦੇ ਵਿੱਚੋਂ ਹੀ ਇੱਕ ਨਵੇਂ ਬੱਚੇ ਨੂੰ ਤਿਆਰ ਕੀਤਾ ਅਤੇ ਉਸਨੂੰ ਉਸ ਚੀਜ਼ਾਂ ਬਾਰੇ ਸਾਰਾ ਸਮਝਾ ਕੇ ਜਿਹੜਾ ਪੂਰੇ ਟਾਈਮ 'ਤੇ ਜਿਹੜਾ ਉਸ ਪ੍ਰੋਜੈਕਟ ਨੂੰ ਤਿਆਰ ਕਰਕੇ ਆਪਣੇ ਪ੍ਰੋਫੈਸਰ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਅਤੇ ਮੇਰਾ ਜਿਹੜਾ ਉਹ ਪ੍ਰੋਜੈਕਟ ਹੈ ਉਹ ਟੀਚਰ ਨੂੰ ਬਹੁਤ ਹੀ ਪਸੰਦ ਆਇਆ ਅਤੇ ਉਹਨੇ ਮੇਰੇ ਕੰਮ ਦੀ ਸਲਾਹੁਣਾ ਕੀਤੀ